ਬੋਲੀਵੁੱਡ ਟੋਲੀਵੁੱਡ ਨੇ ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਇੱਕ ਮਤਲਬ ਆਪਣੀ ਛਾਪ ਛੱਡ ਰੱਖੀ ਹੈ ਤਾਂ ਹਰ ਇੱਕ ਬੰਦਾ ਕਿ ਆਪਣੇ ਆਪ ਨੂੰ ਉਹਨਾਂ ਦੀ ਤਰ੍ਹਾਂ ਮਤਲਬ ਐਕਟ੍ਰੈਸ ਦੀ ਤਰ੍ਹਾਂ ਆਪਣੇ ਆਪ ਨੂੰ ਮੋਡੀਫਾਏ ਕਰਦੀਆਂ ਨੇ ਕੁੜੀਆਂ ਅਤੇ ਐਕਟ੍ਰੈਸ ਦੀ ਤਰ੍ਹਾਂ ਮੋਡੀਫਾਏ ਕਰ ਰਹੇ ਨੇ ਆਪਣੇ ਆਪ ਨੂੰ ਮੁੰਡੇ ਅਤੇ ਉਸੇ ਤਰ੍ਹਾਂ ਮੈਂ ਵੀ ਮਤਲਬ ਬਹੁਤ ਸਾਰੀਆਂ ਮੂਵੀਜ਼ ਦੇਖੀਆ ਪਰ ਮੈਨੂੰ ਉਹਨਾਂ ਦਾ ਨਾਮ ਤਾਂ ਨਹੀਂ ਪਤਾ ਅਤੇ ਕੀ ਨਾਮ ਹੈ ਮੈਨੂੰ ਕੀ ਹੈ ਮਾਧੁਰੀ ਦੀਕਸ਼ਿਤ ਮੈਮ ਜਿਹੜੇ ਵੀ ਮਤਲਬ ਕਿ ਕੋਈ ਵੀ ਡ੍ਰੈਸ ਉਹਨਾਂ ਨੇ ਪਾਇਆ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਉਹਨਾਂ ਦਾ ਅਤੇ ਕੀ ਨਾਮ ਹੈ ਉਹ ਮੈਨੂੰ ਪਰਸਨਲੀ ਮਤਲਬ ਉਹਨਾਂ ਦੀ ਮਤਲਬ ਇੱਕ ਮਤਲਬ ਉਹਨਾਂ ਨੇ ਅਨਾਰਕਲੀ ਸੂਟ ਪਾਇਆ ਸੀ ਅਤੇ ਹਾਂ ਉਹ ਮੈਂ ਮਤਲਬ ਬਣਵਾਉਣ ਦੀ ਕਿਸੇ ਤੋਂ ਕੋਸ਼ਿਸ਼ ਕੀਤੀ ਖੁਦ ਤਾਂ ਨਹੀਂ ਮੇਰੇ ਕੋਲ ਇੰਨਾ ਟਾਈਮ ਕਿ ਮੈਂ ਬਣਾਵਾਂ ਤਾਂ ਮੈਂਨੇ ਮਤਲਬ ਬਣਵਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਵਧੀਆ ਲੱਗਿਆ ਉਹਨਾਂ ਦਾ ਡ੍ਰੈਸਅੱਪ ਅਤੇ ਵਧੀਆ ਢੰਗ ਨਾਲ ਉਹਨਾਂ ਨੇ ਕੈਰੀ ਕੀਤਾ ਹੋਇਆ ਸੀ ਉਹਨਾਂ ਦੇ ਇੱਕ ਪ੍ਰੋਪਰ ਵਧੀਆ ਢੰਗ ਨਾਲ ਕੀ ਹੈ ਉਹਨਾਂ ਨੇ ਹਰੇਕ ਚੀਜ਼ ਨੂੰ ਕੈਰੀ ਕੀਤਾ ਹੁੰਦਾ ਮੈਨੂੰ ਉਨ੍ਹਾਂ ਦੀ ਉਹ ਮਤਲਬ ਚੀਜ਼ ਬਹੁਤ ਵਧੀਆ ਲੱਗਦੀ ਹੈ ਜਿਹੜੀ ਕਿ ਮਤਲਬ ਬਾਕੀ ਸਾਰੇ ਹੁਣ ਵਾਲੇ ਐਕਟ੍ਰੈਸ ਨਾਲੋਂ ਮੈਨੂੰ ਹੱਟ ਕੇ ਲੱਗਦਾ ਹੈ ਜੋ ਚੀਜ਼ ਅਤੇ ਮੈਨੂੰ ਉਹ ਚੀਜ਼ ਵਧੀਆ ਲੱਗਦੀ ਉਹਨਾਂ ਦੀ